ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਇੱਥੇ ਟੂਰਿਸਟ ਸੀਗੀ ਅਤੇ ਮੈਂ ਨਾ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕਾਫੀ ਸੁਣਿਆ ਸੀਗਾ ਉਹਨਾਂ ਦਾ ਨਾਮ ਕਾਫੀ ਸੁਣਿਆ ਤੁਸੀਂ ਮੈਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਉਹਨਾਂ ਬਾਰੇ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਆ ਅੰਮ੍ਰਿਤਸਰ ਸੇ ਨਾ ਠੀਕ ਹੈ ਉਹਨਾਂ ਦੇ ਨਾਲ ਰਿਲੇਟਿਡ ਜੋ ਵੀ ਚੀਜ਼ਾਂ ਹੈਗੀਆਂ ਉਸ ਕਿਲੇ ਦੇ ਵਿੱਚ ਮਤਲਬ ਦੇਖਣ ਨੂੰ ਮਿਲ ਜਾਣਗੀਆਂ ਆਪਾਂ ਨੂੰ ਠੀਕ ਫਿਰ ਮੈਂ ਜਦੋਂ ਵਿਜਿਟ ਕਰਨਾ ਹੋਏਗਾ ਤਾਂ ਮੈਂ ਫਿਰ ਇੱਕ ਵਾਰ ਦੁਬਾਰਾ ਕਾਲ ਕਰਾਂਗੀ ਤੁਹਾਨੂੰ ਹਾਂਜੀ ਥੈਂਕ ਯੂ ਹਾਂਜੀ